ਦਿਹਾਤੀ ਖੇਤਰਾਂਵਾਂ ਦੇ ਵਿੱਚ ਤਕਨਾਲੋਜੀ ਦੀ ਵਰਤੋਂ ਮੁਸ਼ਕਿਲ ਹੈ ਕਿਉਂਕਿ ਉਹਨਾਂ ਨੂੰ ਚੀਜ਼ਾਂ ਨੂੰ ਸਮਝਣਾ ਪੜ੍ਹ ਕੇ ਨਹੀਂ ਸਮਝ ਸਕਦੇ ਹੈ ਜਦ ਉਹਨਾਂ ਨੂੰ ਕੋਈ ਦੱਸਦਾ ਵੀ ਹੈ ਤਾਂ ਉਹ ਉਸ ਚੀਜ਼ ਨੂੰ ਜਲਦੀ ਜਲਦੀ ਮੰਨਦੇ ਨਹੀਂ ਹੈ ਕਿਉਂਕਿ ਅੱਖੋਂ ਹੋਇਆ ਨਹੀਂ ਦੇਖਿਆ ਨਾ ਕਿ ਕਿਵੇਂ ਆ ਜੇ ਅਸੀਂ ਉਹਨਾਂ ਨੂੰ ਡਿਵੇਲੈਪਡ ਜਿਵੇਂ ਬੀਜ ਦੇ ਦਿੱਤੇ ਜਾਂਦੇ ਆ ਉਹ ਕਹਿੰਦੇ ਆ ਬਈ ਪਤਾ ਨਹੀਂ ਇਹਨਾਂ 'ਤੇ ਦਵਾਈਆਂ ਕਿੰਨੀ ਛਿੜਕਣੀਆਂ ਪੈਣੀਆਂ ਕਿਆ ਕਰਨਾ ਪੈਣਾ ਜੇ ਉਹਨਾਂ ਨੂੰ ਦੇ ਦਿੱਤਾ ਜਾਂਦਾ ਹੈ ਕਿ ਆਹ ਸਪ੍ਰੇ ਵਧੀਆ ਆ ਇਹਨੂੰ ਕਰ ਲਓ ਤਾਂ ਉਹ ਉਸ ਚੀਜ਼ ਨੂੰ ਨਹੀਂ ਫੋਲੋ ਕਰਦੇ ਹੈ ਕਿਉਂਕਿ ਉਹਨਾਂ ਉਹ ਆਪਣੇ ਪੁਰਾਣੇ ਤਰੀਕਿਆਂ ਨੂੰ ਅਪਣਾਉਣ 'ਤੇ ਲੱਗੇ ਰਹਿੰਦੇ ਆ ਕਿਉਂਕਿ ਉਹਨਾਂ ਦਾ ਦਿਮਾਗ ਉਹੀ ਉਸੇ ਤਰ੍ਹਾਂ ਸੈੱਟ ਹੈ ਇਸ ਕਰਕੇ ਤਕਨਾਲੋਜੀ ਦਾ ਪ੍ਰਯੋਗ ਮੁਸ਼ਕਿਲ ਹੈ